ਹਾਂਜੀ ਮੈਂ ਤੁਹਾਨੂੰ ਬਰਤਨ ਧੋਣ ਦੇ ਪ੍ਰਕਿਰਿਆ ਬਾਰੇ ਦੱਸ ਸਕਦੀ ਹਾਂ ਜਿਵੇਂ ਕਿ ਬਰਤਨ ਪਹਿਲਾਂ ਜੂਠੇ ਭਾਂਡੇ ਮੈਂ ਪਹਿਲਾਂ ਉੱਦਾਂ ਧੋ ਲੈਂਦੀ ਹਾਂ ਪਾਣੀ ਦੇ ਨਾਲ ਫਿਰ ਉਹਨਾਂ ਨੂੰ ਸਾਬਣ ਦੇ ਨਾਲ ਧੋਨੀ ਹਾਂ ਫਿਰ ਸਭ ਸਰਫ ਸਾਬਣ ਜਿਵੇਂ ਕਿ ਚੁੱਲ੍ਹੇ ਦੀ ਸਵਾਹ ਹੋ ਗਈ ਰੇਤਾ ਕੂਚੇ ਦੇ ਨਾਲ ਸਾਫ ਕਰ ਲੈਂਦੀ ਹਾਂ ਤੇਲ ਵਾਲੇ ਬਰਤਨ ਮੈਂ ਪਹਿਲਾਂ ਗਰਮ ਪਾਣੀ ਦੇ ਨਾਲ ਸਾਫ ਕਰਦੀ ਹਾਂ ਫਿਰ ਉਹਨਾਂ ਨੂੰ ਫਿ ਫਿਰ ਤੋਂ ਸਾਬਣ ਲਾ ਕੇ ਧੋ ਲੈਂਦੀ ਹਾਂ ਬਰਤਨ ਨੂੰ ਫਿਰ ਉਹਨਾਂ ਨੂੰ ਫਿਰ ਸਾਫ ਪਾਣੀ ਦੇ ਨਾਲ ਧੋ ਕੇ ਫਿਰ ਉਹ ਸਾਫ ਕਰਕੇ ਰੱਖ ਲੈਂਦੀ ਹਾਂ ਅਤੇ ਧੰਨਵਾਦ